ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਬਹੁਤ ਸਾਰੀਆਂ ਨਵੀਨਤਾਵਾਂ ਸੰਸਾਰ ਵਿੱਚ ਆ ਗਈਆਂ ਹਨ ਜਿੱਦਾਂ ਕਿ ਐਜੂਕੇਸ਼ਨ ਐਕਸੈਸ ਟੂ ਐਨਰਜੀ ਟੈਲੀਫੋਨ ਜੇ ਸਾਰੇ ਅੰਗਰੇਜ਼ੀ ਦੇ ਸ਼ਬਦ ਹਨ ਸਾ ਮੇਰੇ ਖਿਆਲ ਵਿੱਚ ਵੀ ਬਹੁਤ ਸਾਰੀ ਇੱਦਾਂ ਦੀ ਤਨ ਤਕਨੀਕੀ ਤਰੀਕੇ ਹਨ ਆ ਰਹੇ ਹਨ ਮੇਰੇ ਦਿਮਾਗ ਵਿੱਚ ਜਿਹੜੇ ਕਿ ਅੱਜ ਕੱਲ੍ਹ ਮਨੁੱਖ ਦੀ ਜ਼ਿੰਦਗੀ ਨੂੰ ਆਸਾਨ ਬਣਾ ਰਹੀ ਹੈ ਜਿੱਦਾਂ ਕਿ ਪਹਿਲੇ ਜ਼ਮਾਨੇ ਵਿੱਚ ਕੱਪੜੇ ਧੋਣ ਲਈ ਬਹੁਤ ਸਾਰੇ ਬਹੁਤ ਮੁਸ਼ਕਿਲ ਹੁੰਦੇ ਸੀ ਕੱਪੜੇ ਧੋਣੇ ਪਹਿਲੇ ਜ਼ਮਾਨੇ ਵਿੱਚ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਮਸ਼ੀਨਾਂ ਆ ਗਈਆਂ ਹਨ ਵਾਸ਼ਿੰਗ ਮਸ਼ੀਨਾਂ ਆ ਗਈਆਂ ਹਨ ਜਿਨ੍ਹਾਂ ਨੇ ਇਸਤਰੀਆਂ ਦਾ ਕੰਮ ਔਰਤਾਂ ਦਾ ਕੰਮ ਬਹੁਤ ਹੀ ਜ਼ਿਆਦਾ ਆਸਾਨ ਕਰ ਦਿੱਤਾ ਹਨ ਉਹਨਾਂ ਨੂੰ ਹੱਥ ਨਾਲ ਥਾਪੀਆਂ ਨਾਲ ਕੱਪੜੇ ਨਹੀਂ ਧੋਣੇ ਪੈਂਦੇ ਉਹਨਾਂ ਦੀ ਥਾਂ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਧੋ ਲੈਂਦੇ ਹਨ ਬਹੁਤ ਹੀ ਸਾਰੇ ਇੱਦਾਂ ਦੇ ਤਕਨੀਕੀ ਤਰੀਕੇ ਆ ਗਏ ਹਨ ਜਿੱਦਾਂ ਕਿ ਮੋਬਾਈਲ ਫੋਨ ਆ ਗਏ ਹਨ ਪਹਿਲਾਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਆਪਾਂ ਸਿਰਫ਼ ਚਿੱਠੀਆਂ ਰਾਹੀਂ ਹੀ ਗੱਲ ਕਰ ਸਕਦੇ ਸੀ ਅੱਜ ਕੱਲ੍ਹ ਚਿੱਠੀਆਂ ਦੀ ਥਾਂ ਮੋਬਾਈਲ ਫੋਨ ਟੈਲੀਫੋਨ ਆ ਗਏ ਹਨ ਆਪਾਂ ਕਿਸੇ ਵੀ ਬੰਦੇ ਨਾਲ ਕੰ ਕਿੰਨੀ ਵੀ ਦੂਰ ਫ਼ਾਸਲੇ ਨਾਲ ਵੀ ਗੱਲ ਕਰ ਸਕਦੇ ਹਾਂ ਟੈਲੀਫੋਨ ਰਾਹੀਂ ਮੋਬਾਈਲ ਰਾਹੀਂ ਉਹਨਾਂ ਨੂੰ ਫੋਨ ਕਰ ਸਕਦੇ ਉਹਨਾਂ ਨਾ ਗੱਲਬਾਤ ਕਰ ਸਕਦੇ ਹਾਂ ਉਹਨਾਂ ਨਾਲ ਵੀਡੀਓ ਕਾਲ ਕਰ ਸਕਦੇ ਉਹਨਾਂ ਦੀ ਸ਼ਕਲ ਦੇਖ ਸਕਦੇ ਆਪਾਂ ਹੋਰ ਵੀ ਬਹੁਤ ਸਾਰੇ ਤਕਨੀਕੀ ਤਰੀਕੇ ਆ ਗਏ ਹਨ ਸਾਡੀ ਰਸੋਈ ਵਿੱਚ ਸਾਡੀ ਮਾਤਾ ਲਈ ਸਾਡੀ ਮਾਵਾਂ ਲਈ ਹੋਰ ਵੀ ਬਹੁਤ ਸਾਰੇ ਤਰੀਕੇ ਹਨ ਜਿਨ੍ਹਾਂ ਨਾਲ ਉਹਨਾਂ ਦੀ ਜ਼ਿੰਦਗੀ ਲਈ ਵੀ ਆਸਾਨ ਹੋ ਜਾਂਦੀ ਹੈ ਜਿੱਦਾਂ ਕਿ ਰਸੋਈ ਵਿੱਚ ਪਹਿਲਾਂ ਸਬਜਜ਼ੀਆਂ ਕੱਟਣ ਲਈ ਉਹਨਾਂ ਨੂੰ ਚਾਕੂ ਜਾਂ ਫਿਰ ਹੱਥ ਹੱਥ ਦਾ ਇਸਤੇਮਾਲ ਕਰਨਾ ਪੈਂਦਾ ਸੀ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਗਰੈਂਡਰ ਚੋਪਰ ਇਹਨਾਂ ਸਾਰੀਆਂ ਚੀਜ਼ਾਂ ਨੇ ਉਹਨਾਂ ਦਾ ਕੰਮ ਅਸਾਨ ਕਰ ਦਿੱਤਾ ਹਨ ਹੋਰ ਵੀ ਬਹੁਤ ਸਾਰੀਆਂ ਓਵਨ ਇੱਦਾਂ ਦੀਆਂ ਚੀਜ਼ਾਂ ਆ ਗਈਆਂ ਹਨ ਟੀ ਵੀ ਆ ਗਏ ਹੈ ਟੈਲੀਫੋਨ ਆ ਗਏ ਹੈ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਆ ਗਈਆਂ ਸ ਹਨ ਜਿਨ੍ਹਾਂ ਨੇ ਮਨੁੱਖ ਦੀ ਜ਼ਿੰਦਗੀ ਨੂੰ ਤਰੱਕੀਆਂ ਨਾਲ ਭਰ ਦਿੱਤਾ ਹਨ